ਭੰਗੜੇ ਦੇ ਵਿੱਚ ਭੰਗੜੇ ਦੇ ਵਿੱਚ ਜਿਹੜੇ ਨੌਜਵਾਨ ਲੱਗੇ ਹੁੰਦੇ ਹੈਗੇ ਨੌਜਵਾਨਾਂ ਦੇ ਵਧੀਆ ਕੁੜਤੇ ਕੁੜਤੇ ਨਾਲ ਚਾਦਰਾ ਚਾਦਰਾ ਕੈਂਠਾ ਪੱਗ ਵਧੀਆ ਬੰਨ੍ਹੀ ਹੁੰਦੀ ਹੈਗੀ ਜਿਸ ਨਾਲ ਉਹਨਾਂ ਦੇ ਵਧੀਆ ਟੌਹਰ ਹੁੰਦੀ ਹੈਗੀ ਤਾਂ ਉਹ ਡਾਂਸ ਵੀ ਇੰਨਾ ਭਰਪੂਰ ਕਰਦੇ ਹਨ ਜਿਹੜੇ ਕਿ ਲੋਕਾਂ ਨੇ ਮਨ ਭਾਉਂਦੇ ਹਨ ਜਿਸ ਨਾਲ ਵੀ ਲੋਕਾਂ ਨੂੰ ਇਹ ਚੀਜ਼ ਉਤਸ਼ਾਹ ਹੁੰਦਾ ਹੈ ਕਿ ਅਸੀਂ ਅਗਲੀ ਵਾਰ ਅਸੀਂ ਵੀ ਇਸ ਜਿਹੜੇ ਭੰਗੜੇ ਦੇ ਵਿੱਚ ਪਾਰਟੀਸਪੇਟ ਕਰ ਸਕੀਏ ਵੀ ਇਸ ਭੰਗੜੇ ਦੇ ਵਿੱਚ ਅਸੀਂ ਵੀ ਨੱਚ ਸਕੀਏ ਅਸੀਂ ਵੀ ਇਹੀ ਕੁੜਤਾ ਚਾਦਰਾ ਜਿਹੜਾ ਪਹਿਰਾਵਾ ਹੈਗਾ ਸਾਰਾ ਪਾ ਸਕੀਏ ਕਿਉਂਕਿ ਜਿਹੜਾ ਇਹ ਸੱਭਿਆਚਾਰਕ ਪਹਿਰਾਵਾ ਹੈਗਾ ਭੰਗੜੇ ਵਾਸਤੇ ਤਾਂ ਇਹ ਬਹੁਤ ਹੀ ਵਧੀਆ ਹੁੰਦਾ ਹੈ ਤਾਂ ਇਹ ਜਿਹੜਾ ਦੇਖਣ ਵਾਸਤੇ ਵੀ ਬਹੁਤ ਹੀ ਜ਼ਿਆਦਾ ਵਧੀਆ ਹੈਗਾ ਜਿਸ ਕਰਕੇ ਵੀ ਵੀ ਦੇਖਣ ਨਾਲ ਅਤੇ ਨਾਲੇ ਵੀਡੀਓ ਹੁੰਦਾ ਹੈਗਾ ਭੰਗੜਾ ਪਾਉਂਦੇ ਹੈਗੇ ਜਦੋਂ ਵੀ ਭੰਗੜੇ ਸਟੈਪ ਕਰਦੇ ਹੈਗੇ ਸਟੈਪ ਵੀ ਉਸਦੇ ਬਹੁਤ ਹੀ ਜ਼ਿਆਦਾ ਵਧੀਆ ਹੁੰਦੇ ਹੈਗੇ ਅਤੇ ਨਾਲੇ ਵਧੀਆ ਉਹ ਕਰਦੇ ਹੈਗੇ ਜਦੋਂ ਡਾਂਸ ਕਰਦੇ ਹੈਗੇ ਭੰਗੜਾ ਕਰਦੇ ਹੈਗੇ ਭੰਗੜੇ ਦੇ ਸਟੈਪ ਆ ਜਿਹੜੇ ਬਹੁਤ ਹੀ ਜ਼ਿਆਦਾ ਵਧੀਆ ਹੁੰਦੇ ਆ ਭੰਗੜੇ ਦੇ ਸਟੈਪ ਕਰਨ ਦੇ ਨਾਲ ਨਾਲ ਹੀ ਲੋਕਾਂ ਨੂੰ ਜਿਹੜੇ ਬੈਠੇ ਹੁੰਦੇ ਇਹ ਚੀਜ਼ ਉਤਸ਼ਾਹ ਹੁੰਦਾ ਹੈ ਕਿ ਅਸੀਂ ਅਸੀਂ ਵੀ ਜਾ ਕੇ ਇਹ ਚੀਜ਼ ਭੰਗੜਾ ਕਰੀਏ ਐਵੇਂ ਦੇ ਸਟੈਪ ਅਸੀਂ ਵੀ ਸਿੱਖੀਏ ਜਿਵੇਂ ਦੇ ਸਟੈਪ ਉਹ ਭੰਗੜੇ ਦੇ ਵਿੱਚ ਕਰ ਰਹੇ ਹੁੰਦੇ ਹੈਗੇ ਅਤੇ ਇਸ ਕਰਕੇ ਜਿਹੜੇ ਲੋਕ ਬੈਠੇ ਹੁੰਦੇ ਦੇਖ ਰਹੇ ਹੁੰਦੇ ਉਹਨਾਂ ਨੂੰ ਇਹ ਚੀਜ਼ ਦਾ ਉਤਸ਼ਾਹ ਹੁੰਦਾ ਹੈ ਕਿ ਅਸੀਂ ਵੀ ਅਗਲੇ ਸਾਲ ਇਸ ਪਾਰਟੀਸਪੇਟ ਕਰੀਏ ਇਸ ਸਾਲ ਵੀ ਇਸ ਫੰਕਸ਼ਨ ਵਿੱਚ ਪਾਰਟੀਸਪੇਟ ਕਰੀਏ ਜਿਸ ਕਰਕੇ ਅਸੀਂ ਵਧੀਆ ਭੰਗੜਾ ਪਾ ਸਕੀਏ ਥੈਂਕ ਯੂ